ਹਾਂਜੀ ਇਕਬਾਲ ਕੀ ਹਾਲ ਹਾਂਜੀ ਹਾਂਜੀ ਮੈਂ ਵੀ ਵਧੀਆ ਮੈਂ ਤੁਹਾਨੂੰ ਪੁੱਛਣਾ ਸੀ ਕਿ ਮਤਲਬ ਮੇਰੀ ਹੁਣ ਪਲੱਸ ਟੂ ਕੰਪਲੀਟ ਹੋ ਗਈ ਆ ਅਤੇ ਹੁਣ ਮੇਰਾ ਕੋਲਜ ਜੁਆਇਨ ਕਰਨ ਦਾ ਇਰਾਦਾ ਵਾ ਅਤੇ ਆਪਣੇ ਲਾਗੇ ਕੋਲਜ ਕਿਹੜੇ ਕਿਹੜੇ ਨੇ

ਹਾਂਜੀ ਹਾਂਜੀ ਮੈਂ ਸੀ ਕੇ ਡੀ ਬਾਰੇ ਕਾਫੀ ਸੁਣਿਆ ਵਾ ਹਾਂਜੀ ਉਹੀ ਮੈਨੂੰ ਸਹੀ ਲੱਗਦਾ ਮੇਰਾ ਵੀ ਮਨ ਹੈ ਕਿ ਉੱਥੇ ਮੈਂ ਐਡਮਿਸ਼ਨ ਲਵਾਂ ਹਾਂਜੀ ਉੱਥੇ ਮਤਲਬ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਵਾ ਜਿਵੇਂ ਗੇਮਸ ਹੋ ਗਈਆਂ ਗੇਮਸ ਵਗੈਰਾ ਹੋ ਗਈਆਂ

ਹਾਂਜੀ ਹਾਂਜੀ ਮੈਨੂੰ ਜਦੋਂ ਭੰਗੜੇ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਕਿ ਮੇਰਾ ਮੇਰਾ ਮਨ ਹੈ ਕਿ ਮੈਂ

ਓਕੇ ਓਕੇ ਠੀਕ ਹਾਂਜੀ ਅਤੇ ਹੋਰ ਕੰਪਿਊਟਰ ਲੈਬਜ਼ ਵੀ ਬਹੁਤ ਵਧੀਆ ਉੱਥੇ ਕਿਸ ਤਰ੍ਹਾਂ ਦੀਆਂ ਲੈਬਸ ਆ ਉੱਥੇ

ਹਾਂਜੀ ਓਕੇ ਓਕੇ ਨਹੀਂ ਸਰ ਮੈਂ ਸੀ ਕੇ ਡੀ ਫਿਰ ਐਡਮਿਸ਼ਨ ਲੈਂਦਾ ਵਾ ਕੋਈ ਗੱਲ ਨਹੀਂ ਠੀਕ ਹੈ ਓਕੇ ਥੈਂਕ ਯੂ ਓਕੇ